ਭਾਰਤ ਵਿੱਚ ਸਭ ਤੋਂ ਜ਼ਿਆਦਾ ਸੱਭਿਆਚਾਰਕ ਪਰੰਪਰਾ ਅਤੇ ਇਹ ਵਿਸ਼ਵਾਸ ਹੈ ਕਿ ਭਾਰਤ ਦੇ ਲੋਕ ਰੱਬ 'ਤੇ ਬਹੁਤ ਵਿਸ਼ਵਾਸ ਕਰਦੇ ਹਨ ਈਵਨ ਕਿ ਭਾਰਤ ਦੇ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੇ ਨੇ ਫਿਰ ਹੀ ਮੂੰਹ ਦੇ ਵਿੱਚ ਕੁਛ ਪਾਉਂਦੇ ਹਨ ਇੱਥੇ ਹਰ ਜਗ੍ਹਾ ਹਰ ਟਾਈਮ ਪਲ ਪਲ 'ਤੇ ਰੱਬ ਨੂੰ ਯਾਦ ਕੀਤਾ ਜਾਂਦਾ ਚਾਹੇ ਸੁੱਖ ਹੈ ਚਾਹੇ ਦੁੱਖ ਹੈ ਇੱਥੋਂ ਤੀਕਰ ਕਿ ਇੱਥੇ ਸ਼ਰਾਧ ਦੀ ਪਰੰਪਰਾ ਹੈ ਲੋਕ ਆਪਣੇ ਮ੍ਰਿਤ ਮਾਂ ਪਿਓ ਨੂੰ ਵੀ ਰੋਟੀ ਖਵਾਉਂਦੇ ਹਨ ਕਿ ਸਾਡੇ ਪੂਰਵਜ ਭੁੱਖੇ ਨਾ ਰਹਿਣ ਸੋ ਭਾਰਤ ਦਾ ਇਤਿਹਾਸ ਬੜਾ ਹੀ ਧਾਰਮਿਕ ਹੈ ਔਰ ਇੱਥੇ ਹਰ ਧਰਮਾਂ ਦੀ ਪੂਜਾ ਕੀਤੀ ਜਾਂਦੀ ਹੈ ਇੱਥੇ ਮਾਂ ਪਿਓ ਨੂੰ ਵੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਈ ਲੋਕ ਤਾਂ ਸਵੇਰੇ ਉੱਠ ਕੇ ਆਪਣੇ ਪਹਿਲੇ ਮਾਂ ਪਿਓ ਦੇ ਚਰਨਾਂ ਨੂੰ ਪੈਰੀਂ ਹੱਥ ਲਾਉਂਦੇ ਹਨ ਅਤੇ ਫਿਰ ਦਿਨ ਦੀ ਸ਼ੁਰੂਆਤ ਕਰਦੇ ਹਨ ਜੋ ਕਿ ਆਮ ਦੇਸ਼ਾਂ ਵਿੱਚ ਨਹੀਂ ਦੇਖਿਆ ਜਾ ਸਕਦਾ ਆਮ ਦੇਸ਼ਾਂ ਦੇ ਵਿੱਚ ਕੋਈ ਇਨਸਾਨੀਅਤ ਨਹੀਂ ਹੈ ਭਾਰਤ ਦੇ ਲੋਕਾਂ ਦੇ ਵਿੱਚ ਬਹੁਤ ਇਨਸਾਨੀਅਤ ਇਹ ਹਰ ਇੱਕ ਦੇ ਦੁੱਖ ਦੇ ਵਿੱਚ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹੈ ਅਤੇ ਹਰ ਕੋਈ ਸਭ ਤੋਂ ਪਹਿਲਾਂ ਉਹਨ ਦੀ ਹੈਲਪ ਕਰਨ ਲਈ ਅੱਗੇ ਪਹੁੰਚਦਾ ਹੈ ਲੇਕਿਨ ਬਾਹਰਲੇ ਦੇਸ਼ਾਂ ਦੇ ਵਿੱਚ ਇੱਦਾਂ ਦਾ ਕੋਈ ਨਹੀਂ ਹੈ ਉੱਥੇ ਕੋਈ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ ਹੈ ਇੱਥੇ ਦੇ ਆਂਢ ਗਵਾਂਢ ਆਪਸ ਵਿੱਚ ਬੜੇ ਭਾਈਚਾਰੇ ਨਾਲ ਰਹਿੰਦੇ ਹਨ ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਇੱਥੇ ਆਪਣਾ ਭਾਈਚਾਰਾ ਹੈ ਸਭ ਸਾਂਝੇ ਤਿਉਹਾਰ ਮਨਾਉਂਦੇ ਹਨ ਸਾਰਾ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਜੋ ਕਿ ਆਮ ਦੇਸ਼ਾਂ ਵਿੱਚ ਮਿਲਣਾ ਬਹੁਤ ਮੁਸ਼ਕਿਲ ਹੈ ਬਾਕੀ ਜਿੱਥੇ ਪੋਜੀਟਿਵ ਪੁਆਇੰਟ ਵੀ ਹੁੰਦੇ ਹਨ ਉੱਥੇ ਨੈਗੇਟਿਵ ਵੀ ਹੁੰਦੇ ਹੈ ਬਾਕੀ ਇੱਥੇ ਪਹਿਲੇ ਸਾਡੀ ਸੰਸਕ੍ਰਿਤੀ ਸਾਡਾ ਸਾਡੀ ਯੁਵਾ ਜਨਰੇਸ਼ਨ ਭਟਕੀ ਹੋਈ ਸੀ ਆਪਣੇ ਸੰਸਕ੍ਰਿਤੀ ਤੋਂ ਆਪਣੇ ਕਲਚਰ ਤੋਂ ਪਰ ਹੁਣ ਉਹਨਾਂ ਦੇ ਵਿੱਚ ਜਾਗਰੂਕਤਾ ਆ ਰਹੀ ਹੈ ਉਹ ਆਪਣੇ ਧਰਮ ਪਹਿਚਾਣ ਰਹੇ ਆ ਔਰ ਆਪਣੇ ਧਰਮਾਂ ਦੀ ਸੇਵਾ ਕਰ ਰਹੇ ਹਨ ਜਗ੍ਹਾ ਜਗ੍ਹਾ ਲੰਗਰ ਲਗਾਏ ਜਾ ਰਹੇ ਹਨ ਪ੍ਰਸ਼ਾਦੇ ਛਕਾਏ ਜਾ ਰਹੇ ਹਨ ਗਰੀਬਾਂ ਦੀ ਬੜੀ ਸਹਾਇਤਾ ਕੀਤੀ ਜਾ ਰਹੀ ਹੈ ਕਈ ਸੰਸਥਾਵਾਂ 'ਤੇ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਗਰੀਬਾਂ ਵਾਸਤੇ ਸੰਸਥਾਵਾਂ ਖੋਲ੍ਹੀਆਂ ਹੋਈਆਂ ਹਨ ਕਿ ਕੋਈ ਭੁੱਖਾ ਨਾ ਸੋਵੇ ਇਸ ਕਰਕੇ ਸਾਨੂੰ ਆਪਣੇ ਭਾਰਤ ਦੇ ਸੱਭਿਆਚਾਰਕ ਪਰੰਪਰਾਵਾਂ 'ਤੇ ਬੜਾ ਹੀ ਗਰਵ ਹੈ ਅਤੇ ਸਾਨੂੰ ਮਹਿਸੂਸ ਬੜਾ ਅੱਛਾ ਮਹਿਸੂਸ ਹੁੰਦਾ ਕਿ ਅਸੀਂ ਭਾਰਤੀ ਹਾਂ